ਪੰਜਾਬੀ ਸੱਭਿਆਚਾਰ ਵਿੱਚ ਭੰਗੜੇ ਦੀ ਬਹੁਤ ਹੀ ਜ਼ਿਆਦਾ ਮਹੱਤਤਾ ਹੈ ਭੰਗੜਾ ਪੰਜਾਬ ਦਾ ਪ੍ਰਸਿੱਧ ਲੋਕ ਨਾਚ ਹੈ ਪੰਜਾਬ ਵਿੱਚ ਭੰਗੜਾ ਹਰ ਇੱਕ ਖੁਸ਼ੀ ਦੇ ਮੌਕੇ 'ਤੇ ਪਾਇਆ ਜਾਂਦਾ ਹੈ ਅਤੇ ਪੰਜਾਬ ਵਿੱਚ ਅਤੇ ਪੰਜਾਬ ਤੋਂ ਬਾਹਰ ਜਿੱਥੇ ਕਿਤੇ ਵੀ ਪੰਜਾਬੀ ਵਸਦੇ ਹਨ ਇਹ ਕਦੇ ਵੀ ਨਹੀਂ ਹੋ ਸਕਦੇ ਕਿਉਂਕਿ ਭੰਗੜਾ ਪਾਇਆ ਹੀ ਨਾ ਜਾਵੇ ਕਿਉਂਕਿ ਭੰਗੜਾ ਇੱਕ ਇੱਦਾਂ ਦਾ ਨਾਚ ਹੈ ਜੋ ਹਰ ਇੱਕ ਬੰਦਾ ਪਸੰਦ ਕਰਦਾ ਹੈ ਕਿਸੇ ਵੀ ਮੌਕੇ 'ਤੇ ਬੇਸ਼ਕ ਉਹ ਕਿਸੇ ਦਾ ਲੋਹੜੀ ਦਾ ਫੰਕਸ਼ਨ ਹੋਵੇ ਬੇਸ਼ਕ ਕਿਸੇ ਕੁੜੀ ਦਾ ਵਿਆਹ ਹੋਵੇ ਜਾਂ ਫਿਰ ਮੁੰਡੇ ਦਾ ਵਿਆਹ ਹੋਵੇ ਉਹ ਭੰਗੜਾ ਕਰੇ ਬਿਨਾਂ ਰਹਿ ਹੀ ਨਹੀਂ ਸਕਦੇ ਅਤੇ ਜੇਕਰ ਉਹ ਭੰਗੜਾ ਨਾ ਕਰਨ ਤਾਂ ਉਹਨਾਂ ਦੇ ਦਿਲ ਨੂੰ ਸੰਤੁਸ਼ਟੀ ਨਹੀਂ ਪੈਂਦੀ ਭੰਗੜਾ ਉਦਾਂ ਤਾਂ ਪੰਜਾਬ ਦੇ ਕਿਸਾਨਾਂ ਵੱਲੋਂ ਫਸਲ ਪੱਕਣ ਦੀ ਖੁਸ਼ੀ ਵਿੱਚ ਵਿਸਾਖੀ ਦੇ ਤਿਉਹਾਰ 'ਤੇ ਵੀ ਮਨਾਇਆ ਜਾਂਦਾ ਹੈ ਬਹੁਤ ਸਾਰੇ ਭੰਗੜੇ ਦੇ ਸਟੈਪ ਹਨ ਜਿਵੇਂ ਝੁੰਮਰ ਲੁੱਡੀ ਧਮਾਲ ਹਨ ਅਤੇ ਭੰਗੜਾ ਪੰਜਾਬ ਦੇ ਤਿਉਹਾਰਾਂ ਵਿੱਚ ਇੱਕ ਬਹੁਤ ਹੀ ਮਹੱਤਵਪੂਰਨ ਹਿੱਸਾ ਹੈ